ਹੈਲੋ ਹਾਂਜੀ ਸਰ ਉਬਰ ਸਰਵਿਸ ਤੋਂ ਗੱਲ ਕਰ ਰਹੇ ਹੋ ਹਾਂਜੀ ਸਰ ਮੈਂ ਨਾ ਆਪਣੀ ਕੈਬ ਬੁੱਕ ਕਰਵਾਈ ਸੀਗੀ ਬਠਿੰਡਾ ਤੋਂ ਅੰਮ੍ਰਿਤਸਰ ਲਈ ਤਾਂ ਮੈਨੂੰ ਤੁਹਾਡੀ ਕੈਬ ਦੇ ਵਿੱਚੋਂ ਥੋੜ੍ਹਾ ਜਿਹਾ ਮਾੜਾ ਤਜਰਬਾ ਹੋਇਆ ਤਾਂ ਮੈਂ ਤੁਹਾਡੇ ਨਾਲ ਉਹਦੀ ਸ਼ਿਕਾਇਤ ਦਰਜ ਕਰਨੀ ਚਾਹੁੰਦਾ ਹਾਂਜੀ ਅਤੇ ਸ ਸਰ ਇੱਕ ਤਾਂ ਤੁਹਾਡੀ ਕੈਬ ਪਹਿਲਾਂ ਹੀ ਬਹੁਤ ਲੇਟ ਆਈ ਸੀ ਤਾਂ ਮੈਂ ਇੰਟਰਵਿਊ ਲਈ ਜਾਣਾ ਸੀਗਾ ਅਤੇ ਤੁਹਾਡੀ ਕੈਬ ਰਾਹ 'ਚ ਜਾਂਦੇ ਜਾਂਦੇ ਪੈਂਚਰ ਹੋ ਗਈ ਅਤੇ ਪੈਂਚਰ ਹੋ ਗਈ ਅਤੇ ਜਦੋਂ ਪੈਂਚਰ ਠੀਕ ਹੋਇਆ ਤਾਂ ਤੁਹਾਡੇ ਡਰਾਈਵਰ ਦਾ ਵੀ ਬਹੁਤ ਮਾੜਾ ਐਕਸਪੀਰੀਅੰਸ ਸੀਗਾ ਉਹ ਆਖੇ ਨਹੀਂ ਲੱਗਦਾ ਸੀਗਾ ਅਤੇ ਅਸੀਂ ਉਹਨੂੰ ਕਾਰ ਤੇਜ਼ ਕਰਨ ਲਈ ਕਿਹਾ ਉਹਨੇ ਤਾਂ ਨਹੀਂ ਤੇਜ਼ ਕੀਤੀ ਨਾ ਤੁਹਾਡੀ ਕੈਬ ਦੇ ਵਿੱਚ ਚੰਗੀ ਤਰ੍ਹਾਂ ਏਅਰ ਕੰਡੀਸ਼ਨਰ ਕੰਮ ਕਰ ਰਿਹਾ ਸੀਗਾ ਜੀ ਅਤੇ ਇੰਟਰਵਿਊ ਲਈ ਜਾਣਾ ਸੀ ਤਾਂ ਅਸੀਂ ਲੇਟ ਹੋ ਗਏ ਤਾਂ ਉ ਅਸੀਂ ਭਰਪਾਈ ਮੰਗੀ ਵੀ ਸਾਡਾ ਜਿਹੜਾ ਕੰਮ ਸੀਗਾ ਉਹ ਤਾਂ ਤੁਹਾਡਾ ਤੋਂ ਹੋਇਆ ਹੀ ਨਹੀਂ ਅਤੇ ਇਹ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਤੁਹਾਡੀ ਕੈਬ ਦੀ ਸਰਵਿਸ ਆ ਜਿਹੜੀ ਸਾਨੂੰ ਬਿਲਕੁਲ ਵੀ ਵਧੀਆ ਨਹੀਂ ਲੱਗੀ ਗੀ ਅਤੇ ਮੈਂ ਚਾਹੁੰਦਾ ਵੀ ਅੱਗੇ ਤੋਂ ਤੁਸੀਂ ਇਸ ਨੂੰ ਸੁਧਾਰੋ ਤਾਂ ਕਿ ਅੱਗੇ ਤੋਂ ਕੋਈ ਸ਼ਿਕਾਇਤ ਨਾ ਆਵੇ ਤੁਹਾਡੀ ਕਾਰ ਦੀਆਂ ਸੀਟਸ ਵੀ ਬਹੁਤ ਗੰਦੀਆਂ ਸੀਗੀਆਂ ਅਤੇ ਹਾਈਜੈਨਿਕ ਵੀ ਬਹੁਤ ਘੱਟ ਸੀ ਸਾਫ਼ ਸਫ਼ਾਈ ਦਾ ਥੋੜ੍ਹਾ ਧਿਆਨ ਰੱਖਿਆ ਜਾਵੇ ਇੱਦਾਂ ਨਾ ਕੀਤਾ ਜਾਵੇ ਅੱਗੇ ਤੋਂ ਕੋਈ ਸ਼ਿਕਾਇਤ ਨਾ ਆਵੇ ਹਾ ਹਾਂਜੀ ਤਾਂ ਕਿ ਸਾਨੂੰ ਸਫ਼ਰ ਕਰਨਾ ਥੋੜ੍ਹਾ ਜਿਹਾ ਸੌਖਾ ਹੋਵੇ